ਸਾਡੇ ਇੱਥੇ ਸ਼ਹਿਰ ਤੋਂ ਇੱਕ ਸ ਬੱਸ ਸੇਵਾ ਚਲਦੀ ਹੈ ਉਹਦੇ ਵਿੱਚ ਉਹ ਸਾਨੂੰ ਪੂਰੇ ਪੰਜਾਬ ਦੇ ਗੁਰਦੁਆਰੇ ਘੁੰਮਾਉਂਦੇ ਆ ਅਤੇ ਉਹ ਬੜਾ ਰੀਜਨੇਬਲ ਜਿਹਾ ਬਹੁਤ ਥੋੜ੍ਹਾ ਜਿਹਾ ਪੈਸੇ ਲੈਂਦੇ ਲੋਕਾਂ ਤੋਂ ਜਾਇਜ਼ ਜਿਹੇ ਪੈਸੇ ਜਿਹਨੂੰ ਕਹਿੰਦੇ ਆਪਾਂ ਬਹੁਤ ਘੱਟ ਖ਼ਰਚੇ ਦੇ ਵਿੱਚ ਉਹਨਾਂ ਨੂੰ ਘੁੰਮਾ ਦਿੰਦੇ ਆ ਉਹਦੇ 'ਚ ਸਾਨੂੰ ਇਹ ਮਹਿਸੂਸ ਹੁੰਦਾ ਆ ਵੀ ਜਿਹੜਾ ਖਰਚਾ ਸਾਡੇ ਤੋਂ ਉਹ ਲੈ ਰਹੇ ਆ ਉਹ ਮਲ ਕਿ ਇਹ ਨਹੀਂ ਹੈ ਕਿ ਉਹ ਕੁਝ ਕਮਾਉਣ ਦੇ ਮੰਤਵ ਨਾਲ ਲੈ ਰਹੇ ਆ ਅਸਲ ਦੇ ਵਿੱਚ ਉਹ ਆਪਣੇ ਇੱਕ ਅਨਾਥ ਆਸ਼ਰਮ ਚਲਾਉਂਦੇ ਆ ਅਤੇ ਇੱਕ ਬਜ਼ੁਰਗਾਂ ਵਾਸਤੇ ਔਲਡ ਏਜ ਹੋਮ ਵੀ ਚਲਾਉਂਦੇ ਆ ਉਹ ਜਿੱਥੇ ਤੋਂ ਉਹ ਪੈਸਾ ਕਮਾਇਆ ਹੋਇਆ ਉੱਥੇ ਉਹ ਖਰਚ ਦਿੰਦੇ ਆ ਤਾਂ ਸਾਨੂੰ ਉਹ ਬੜਾ ਚੰਗਾ ਲੱਗਦਾ ਇੱਕ ਤਰ੍ਹਾਂ ਦੀ ਚੈਰਿਟੀ ਹੋ ਜਾਂਦੀ ਹੈ ਅਤੇ ਜਿਹੜੇ ਲੋਕਾਂ ਨੇ ਆਪਣਾ ਘੁੰਮਣਾ ਹੁੰਦਾ ਉਹ ਆਪਣਾ ਘੁੰਮ ਫਿਰ ਵੀ ਲੈਂਦੇ ਹੈ ਅਤੇ ਗੁਰਦੁਆਰਿਆਂ ਦੇ ਦਰਸ਼ਨ ਵੀ ਉਹਨਾਂ ਨੂੰ ਹੋ ਲੈਂਦੇ ਹੈ